ਕਲਾਕਾਰ ਆਪਣੇ ਪ੍ਰੋਗਰਾਮ ਕਰਦੇ ਸਮੇਂ ਇਹ ਧਿਆਨ ਰੱਖਦੇ ਹਨ ਕਿ ਸਾਡੇ ਕਰਕੇ ਕਿਸੀ ਧਰਮ ਜਾਂ ਲੋਕਾਂ ਨੂੰ ਠੇਸ ਨਾ ਪਹੁੰਚੇ